ਹਾਂ ਮੈਂ ਬਹੁਤ ਵਾਰੀ ਸਕੂਲ ਦੇ ਫੰਕਸ਼ਨ ਵਿੱਚ ਹਿੱਸਾ ਲਿਆ ਹੈ ਅਤੇ ਦੇਖਿਆ ਵੀ ਹੈ ਮੇਰਾ ਤਜਰਬਾ ਇਹ ਹੈ ਕਿ ਸਾਨੂੰ ਸਕੂਲ ਦੇ ਫੰਕਸ਼ਨ ਵਿੱਚ ਹਿੱਸਾ ਲੈਣ ਨਾਲ ਬਹੁਤ ਵੱਡੀ ਮੁਹਾਰਤ ਹਾਸਿਲ ਹੁੰਦੀ ਹੈ ਅਤੇ ਇਹ ਫੰਕਸ਼ਨ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਸਾਡੇ ਅੰਦਰਲੇ ਹੁਨਰ ਨੂੰ ਬਾਹਰ ਕੱਢਦੇ ਹਨ